ਹੈਲੋ ਓਲਾ ਕੈਬ ਤੋਂ ਬੋਲਦੇ ਹੋ ਜੀ ਆਪ ਜੀ ਦੀ ਇੱਕ ਕੈਬ ਬੁੱਕ ਕੀਤੀ ਸੀ ਡਰਾਈਵਰ ਦਾ ਨਾਮ ਹਰਿੰਦਰ ਸਿੰਘ ਹੈ ਪਰੰਤੂ ਜਿਹੜੀ ਆਪਦੀ ਕੈਬ ਹੈ ਉਹ ਸਮੇਂ ਸਿਰ ਨਹੀਂ ਪਹੁੰਚ ਰਹੀ ਹੈ ਇਸ ਲਈ ਮੈਂ ਆਪਣੇ ਸਮੇਂ ਤੋਂ ਲੇਟ ਹੋ ਰਿਹਾਂ ਕਿਰਪਾ ਕਰਕੇ ਮੇਰੀ ਜਿਹੜੀ ਕੈਬ ਹੈ ਉਹ ਰੱਦ ਕਰ ਦਿੱਤੀ ਜਾਵੇ ਮੈਂ ਹੋਰ ਕੈਬ ਕਰਕੇ ਜਾ ਰਿਹਾਂ